ਮੈਂ ਦੌੜਣ ਲਈ ਸਪੋਰਟਸ ਸ਼ੂਜ਼ ਦੀ ਵਰਤੋਂ ਕਰਦੀ ਹਾਂ ਮੈਂ ਇਹਨਾ ਸ਼ੂਜ਼ ਨੂੰ ਹੀ ਤਰਜੀਹ ਦਿੰਦੀ ਹਾਂ ਕਿਉਂਕਿ ਜੇਕਰ ਅਸੀਂ ਆਮ ਚੱਪਲਾਂ ਜਾਂ ਹੋਰ ਕੋਈ ਚੀਜ਼ ਪਾ ਕੇ ਦੌੜਦੇ ਹਾਂ ਤਾਂ ਸਾਨੂੰ ਗਰਾਊਂਡ ਵਿੱਚ ਸੱਟ ਲੱਗਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਸ ਕਰਕੇ ਸਾਡੇ ਦੌੜਨ ਵਿੱਚ ਰੁਕਾਵਟਾਂ ਆ ਸਕਦੀਆਂ ਹਨ ਮੈਂ ਦੌੜਨ ਦੇ ਲਈ ਲੋਅਰ ਟੀਸ਼ਰਟ ਜਾਂ ਟਰੈਕ ਸੂਟ ਦੀ ਵਰਤੋਂ ਕਰਦੀ ਹਾਂ ਕਿਉਂਕਿ ਇਹਨਾਂ ਦੀ ਵਰਤੋਂ ਨਾਲ ਅਸੀਂ ਆਰਾਮ ਨਾਲ ਬਿਨਾਂ ਕਿਸੇ ਰੁਕਾਵਟ ਦੇ ਭੱਜ ਸਕਦੇ ਹਾਂ ਅਤੇ ਸਾਡੇ ਡਿੱਗਣ ਦੇ ਬਹੁਤ ਘੱਟ ਚਾਂਸ ਹੁੰਦੇ ਹਨ ਅਤੇ ਮੈਨੂੰ ਇਹਨਾਂ ਵਿੱਚ ਬਹੁਤ ਆਰਾਮ ਵੀ ਮਹਿਸੂਸ ਹੁੰਦਾ ਹੈ